ਹੈਲੋ ਜੀ ਹੈਲੋ ਸਰ ਸਤਿ ਸ਼੍ਰੀ ਅਕਾਲ ਸਰ ਜੀ ਪੰਜਾਬ ਤੋਂ ਦੀਦਾਰ ਸਿੰਘ ਛੇਤਰਾ ਜੀ ਬੋਲਦੇ ਜੀ ਸਰ ਮੈਂ ਮੁੰਬਈ ਤੋਂ ਬੋਲ ਰਿਹਾ ਜੀ ਨਰੇਸ਼ ਕੁਮਾਰ ਅਤੇ ਮੈਂ ਪੰਜਾਬ ਆਉਣਾ ਚਾਹੁੰਦਾ ਜੀ ਤੁਹਾਡੀਆਂ ਸੇਵਾਵਾਂ ਥੋੜ੍ਹੀਆਂ ਲੈਣਾ ਚਾਹੁੰਦਾ ਅਤੇ ਇੱਕ ਥੋੜ੍ਹਾ ਜਿਹਾ ਹਾਂਜੀ ਇੱਕ ਥੋੜ੍ਹਾ ਜਿਹਾ ਹੋਰ ਸੀਗਾ ਜੀ ਵਿਸ਼ਾ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਜਿਹੜੇ ਵੀ ਸਥਾਨ ਹੈ ਜਾਂ ਜਿੱਦਾਂ ਵੀ ਜਾਣਕਾਰੀ ਹੈ ਉਹ ਥੋੜ੍ਹੀ ਮੈਂ ਪੰਜਾਬ ਤੋਂ ਪ੍ਰਾਪਤ ਕਰਨਾ ਚਾਹੁੰਦਾ ਵੀ ਕਿੱਥੇ ਕਿੱਥੇ ਉਹਨਾਂ ਨਾਲ਼ ਮਤਲਬ ਜੁੜੇ ਵੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਵੈਸੇ ਤੁਹਾਡੇ ਧਿਆਨ 'ਚ ਇੱਥੇ ਪੰਜਾਬ 'ਚ ਕਿੱਥੇ ਕਿੱਥੇ ਉਹਨਾਂ ਨਾਲ਼ ਸੰਬੰਧਿਤ ਕੋਈ ਯਾਦਗਾਰ ਜਾਂ ਕੋਈ ਹੋਰ ਇੱਦਾਂ ਦਾ ਸਥਾਨ ਕੋਈ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ

ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ

ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਚਲੋ ਜੀ ਬਹੁਤ ਵਧੀਆ ਜੀ ਤੁਸੀਂ ਜਾਣਕਾਰੀ ਦਿੱਤੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ

ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ

ਬਸ ਹਾਂਜੀ ਬਸ ਕੋਈ ਗੱਲ ਨਹੀਂ ਜੀ ਮੈਂ ਹਾਂ ਤੁਹਾਨੂੰ ਕਾਲ ਕਰਕੇ ਪਹਿਲਾਂ ਤੁਹਾਡਾ ਮਤਲਬ ਕਿ ਸਮਾਂ ਲੈ ਕੇ ਦੱਸ ਕੇ ਤੁਹਾਨੂੰ ਅਤੇ ਫਿਰ ਹੀ ਮੈਂ ਆਵਾਂਗਾ ਜੀ ਅਤੇ ਫਿਰ ਮੇਰੇ ਲਈ ਜਿਹੜੇ ਪੰਜ ਚਾਰ ਦਿਨ ਉਹ ਤੁਸੀਂ ਲਾਜ਼ਮੀ ਹਫ਼ਤਾ ਜਿਹੜਾ ਵੀ ਜਿੰਨਾਂ ਵੀ ਸਮਾਂ ਲੱਗਿਆ ਜ਼ਰੂਰ ਕੱਢਿਓ ਜੀ ਹਾਂ ਹਾਂ ਹਾਂਜੀ ਠੀਕ ਹੈ ਸਰ ਬਹੁਤ ਮਿਹਰਬਾਨੀ ਜੀ ਓਕੇ ਜੀ ਸਤਿ ਸ਼੍ਰੀ ਅਕਾਲ